ਪੰਜਾਬ ਵਿੱਚ ਬੈਠੇ ਹਾਂ ਰੋਟੀ ਖਾ ਰਹੇ ਹਾਂ ਅਤੇ ਅਚਾਰ ਨਾ ਹੋਵੇ ਸ਼ਾਮਿਲ ਹੋ ਨਹੀਂ ਸਕਦਾ ਪੰਜਾਬ ਦੇ ਵਿੱਚ ਖਾਣੇ ਦੇ ਨਾਲ ਅਚਾਰ ਨੂੰ ਬਹੁਤ ਜ਼ਰੂਰੀ ਮੰਨਿਆ ਗਿਆ ਕਿਉਂਕਿ ਜੇ ਸਬਜ਼ੀ ਵਿੱਚ ਥੋੜ੍ਹਾ ਬਹੁਤ ਉਨੀ ਇੱਕੀ ਦਾ ਫਰਕ ਰਹਿ ਗਿਆ ਤਾਂ ਅਚਾਰ ਉਸ ਕਮੀ ਨੂੰ ਪੂਰਾ ਕਰ ਦਿੰਦਾ ਅਤੇ ਪੰਜਾਬੀ ਜਾਣੇ ਹੀ ਜਾਂਦੇ ਆ ਮਸਾਲੇਦਾਰ ਖਾਣੇ ਵਾਸਤੇ ਅਤੇ ਅਚਾਰ ਛੋਟਾ ਜਿਹਾ ਮਸਾਲੇ ਰੂਪੀ ਭੰਡਾਰ ਹੁੰਦਾ ਮਸਾਲਿਆਂ ਦਾ ਜੋ ਕਿ ਭੋਜਨ ਨੂੰ ਹੋਰ ਸਵਾਦਿਸ਼ਟ ਬਣਾ ਦਿੰਦਾ ਅਤੇ ਇੱਕ ਜ਼ਾਇਕਾ ਹੁੰਦਾ ਭੋਜਨ ਦਾ ਉਹਨੂੰ ਉਹ ਕੰਪਲੀਟ ਕਰ ਦਿੰਦਾ ਪੂਰਾ ਕਰ ਦਿੰਦਾ ਅਸੀਂ ਦੇਖਿਆ ਕਿ ਅੰਬ ਦਾ ਅਚਾਰ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦਾ ਅਤੇ ਅੰਬ ਦੇ ਅਚਾਰ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਕੱਚੇ ਅੰਬ ਲੈ ਲਓ ਉਹਨਾਂ ਨੂੰ ਚੰਗੀ ਤਰਾਂ ਧੋ ਲਓ ਉਹਨਾਂ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਜਿਹਜੇ ਤੁਹਾਨੂੰ ਪਸੰਦ ਨੇ ਉਹਨਾਂ 'ਚ ਕੱਟ ਲਓ ਫਿਰ ਸੁਕਾ ਲਓ ਉਸ ਤੋਂ ਬਾਅਦ ਉਹਦੇ ਵਿੱਚ ਸੌਂਫ ਹੋ ਗਿਆ ਅਜਵਾਇਣ ਹੋ ਗਈ ਲੂਣ ਮਿਰਚ ਹਲਦੀ ਸਾਰੇ ਛੋਟੇ ਛੋਟੇ ਜੋ ਮਸਾਲੇ ਜੋ ਆਪਾਂ ਨੂੰ ਘਰ ਘਰਾਂ ਵਿੱਚ ਆਸਾਨੀ ਨਾਲ ਮਿਲ ਜਾਂਦੇ ਨੇ ਉਹ ਓਨੀ ਕੁ ਮਾਤਰਾ 'ਚ ਜਿੰਨੇ ਕਿ ਉਹਨਾਂ ਦੇ ਵਿੱਚ ਮਤਲਬ ਕਿ ਜਿੰਨੇ ਕਿ ਉਹਦੇ ਵਿੱਚ ਖਪ ਜਾਣ ਪਾ ਦਿਓ ਸਾਰਿਆਂ ਨੂੰ ਮਿਕਸ ਕਰ ਦਿਓ ਅਤੇ ਥੋੜ੍ਹੇ ਦਿਨ ਰੱਖੋ ਮੈਨੂੰ ਲੱਗਦਾ ਕਿ ਪੰਦਰਾਂ ਕੁ ਦਿਨ ਤੋਂ ਬਾਅਦ ਅਚਾਰ ਖਾਣ ਵਾਸਤੇ ਉਹ ਤਿਆਰ ਹੋ ਜਾਂਦਾ ਅਤੇ ਕੋਈ ਜ਼ਿਆਦਾ ਵੀ ਵੱਡਾ ਇਹ ਰੋਕਟ ਸਾਇੰਸ ਨਹੀਂ ਹੈਗੀ ਇਹਦੇ ਵਿੱਚ ਅਚਾਰ ਬਣਾਉਣ ਦੇ ਵਿੱਚ ਅਤੇ ਇਹ ਬਹੁਤ ਵਧੀਆ ਅਚਾਰ ਤਿਆਰ ਹੋ ਜਾਂਦਾ ਅੱਜ ਕੱਲ੍ਹ ਤਾਂ ਸਿੱਧੇ ਦੁਕਾਨਾਂ ਵਿੱਚ ਹੀ ਮਸਾਲੇ ਬਣੇ ਬਣਾਏ ਪੰਜ ਕਿਲੋ ਦੇ ਹਿਸਾਬ ਨਾਲ ਢਾਈ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੇ ਨੇ ਅਤੇ ਅਚਾਰ ਬਣਾਉਣਾ ਹੁਣ ਕੋਈ ਵੱਡੀ ਗੱਲ ਨਹੀਂ ਰਹਿ ਗਈ ਹੈ ਕਿ ਬੜੇ ਲੋਕ ਹੀ ਬਣਾਉਣ ਮਤਲਬ ਕਿ ਦਾਦੀਆਂ ਹੀ ਬਣਾਉਣ ਅਤੇ ਅੱਜ ਕੱਲ੍ਹ ਕੋਈ ਵੀ ਅਚਾਰ ਅਸਾਨੀ ਨਾਲ ਪਾ ਸਕਦਾ ਕਿਉਂਕਿ ਆਪਾਂ ਨੂੰ ਅੱਜ ਕੱਲ੍ਹ ਬਣੇ ਬਣਾਏ ਮਸਾਲੇ ਮਿਲ ਜਾਂਦੇ ਨੇ ਇਸ ਲਈ ਤੁਸੀਂ ਜੋ ਅਚਾਰ ਬਣਾਉਣਾ ਤਾਂ ਬਾਹਰੋਂ ਮਸਾਲਾ ਲੈ ਕੇ ਅੰਬ ਆਪਣੇ ਘਰ ਦੇ ਕੱਟ ਕੇ ਆਸਾਨੀ ਨਾਲ ਬਣਾ ਸਕਦੇ ਹੋ ਧੰਨਵਾਦ